ਹੈ ਜਿਹੜਾ ਮੈਂ ਪ੍ਰੋਡਕਟ ਲਿੱਤਾ ਸੀਗਾ ਮੋਟੋਰੋਲਾ ਜ਼ੈਡ ਵਨ ਜ਼ੀਰੋ ਇਹਦੀ ਪੈਕੇਜਿੰਗ ਚੰਗੀ ਨਹੀਂ ਸੀਗੀ ਉਹ ਤਾਂ ਸ਼ੁਕਰ ਹੈ ਪਰਮਾਤਮਾ ਦਾ ਫ਼ੋਨ ਟੁੱਟਿਆ ਨਹੀਂ ਪਰ ਇਹਦੀ ਪੈਕਿੰਗ ਠੀਕ ਕਰਨ ਦੀ ਲੋੜ ਹੈਗੀ ਹੈ ਦੂਜਾ ਇਹ ਜਿਹੜਾ ਮੋਬਾਇਲ ਹੈਗਾ ਇਹਦਾ ਵਜ਼ਨ ਬੜਾ ਜ਼ਿਆਦਾ ਹੈਗਾ ਇੱਕ ਸੌ ਨੱਬੇ ਗਰਾਮ ਵਜ਼ਨ ਬਹੁਤ ਜ਼ਿਆਦਾ ਹੈਗਾ ਇੱਦਾਂ ਦੇ ਮੋਬਾਇਲ ਲਈ ਇਹਦੀ ਬੈਟਰੀ ਵੀ ਬੜੀ ਜਲਦੀ ਮੁੱਕ ਜਾਂਦੀ ਹੈ ਸਾਢੇ ਚਾਰ ਹਜਾਰ ਐਮ ਏ ਐਚ ਦੀ ਬੈਟਰੀ ਹੈ ਇਹਦੀ ਥਾਂ ਵੱਡੀ ਬੈਟਰੀ ਦਿੱਤੀ ਜਾ ਸਕਦੀ ਹੈ ਡਿਸਪਲੇਅ ਵੀ ਐੱਲ ਸੀ ਡੀ ਵਾਲਾ ਹੈਗਾ ਜਿਹੜਾ ਇੰਨੀ ਵਧੀਆ ਬਾਹਰ ਰੋਸ਼ਨੀ ਵਿੱਚ ਨਜ਼ਰ ਨਹੀਂ ਆਉਂਦਾ